ਮੇਰੇ ਘਰ ਦੇ ਕੋਲ ਇੱਕ ਲਾਈਬ੍ਰੇਰੀ ਹੈ ਅਤੇ ਮੈਂ ਜਦ ਵੀ ਮੇਰਾ ਟਾਈਮ ਲੱਗਦਾ ਹੈ ਅਤੇ ਮੈਂ ਉੱਥੇ ਜਾਂਦੀ ਹਾਂ ਮੈਨੂੰ ਉੱਥੇ ਅਧਿਆਤਮਕ ਕਿਤਾਬਾਂ ਪੜ੍ਹਨੀਆਂ ਬਹੁਤ ਵਧੀਆ ਲੱਗਦੀਆਂ ਹਨ ਜਿਸ ਤਰ੍ਹਾਂ ਕਿ ਪੁਰਾਣੇ ਟਾਈਮ ਦੇ ਕਿੱਸੇ ਪੁਰਾਣੀਆਂ ਜਨਰਲ ਨੌਲੇਜ ਦੀਆਂ ਕਿਤਾਬਾਂ ਉਸ ਪੁਰਾਣੇ ਟਾਈਮ ਦੇ ਵਿੱਚ ਕਿਹੜੀਆਂ ਕਿਹੜੀਆਂ ਕਹਾਵਤਾਂ ਹੋਈਆਂ ਕਿਹੜੀਆਂ ਕਿਹੜੀਆਂ ਜੋ ਸਮਾਂ ਹੋਇਆ ਔਰ ਜੋ ਉਸਦਾ ਇਤਿਹਾਸ ਬਾਰੇ ਕਿਉਂਕਿ ਮੈਂ ਕਿਤਾਬ ਲਾਇਬ੍ਰੇਰੀ ਤੋਂ ਇਲਾਵਾ ਮੈਂ ਫਰੀ ਟਾਈਮ ਦੇ ਵਿੱਚ ਮੋਬਾਇਲ 'ਤੇ ਵੀ ਇਹ ਸਰਚ ਕਰਕੇ ਦੇਖਦੀ ਹੁੰਦੀ ਹਾਂ ਬਟ ਜੋ ਚੀਜ਼ ਮੈਨੂੰ ਪੜ੍ਹਨ ਦੇ ਵਿੱਚ ਵਧੀਆ ਲੱਗਦੀ ਉਹਦੇ ਵਿੱਚ ਮੈਂ ਪੁਰਾਣੇ ਧਾਰਮਿਕ ਗ੍ਰੰਥ ਜਿਵੇਂ ਕਿ ਰਮਾਇਨ ਗੀਤਾ ਭਗਵਤ ਗੀਤਾ ਇਸ ਤਰ੍ਹਾਂ ਦੇ ਸ਼ਿਵ ਪੁਰਾਨ ਵਗੈਰਾ ਪੜ੍ਹਨਾ ਪਸੰਦ ਕਰਦੀ ਹਾਂ ਔਰ ਉਹਦੇ ਵਿੱਚ ਸਾਨੂੰ ਆਪਣੇ ਇਤਿਹਾਸ ਬਾਰੇ ਕਿਉਂਕਿ ਮੈਂ ਹਿੰਦੂ ਰਿਲੀਜਨ ਨਾਲ ਕਰਦੀ ਹਾਂ ਅਤੇ ਮੈਂ ਉਸ ਉਹਦਾ ਇਤਿਹਾਸ ਜਾਣਨ ਦੇ ਵਿੱਚ ਮੈਨੂੰ ਬਹੁਤ ਉਕਸੁਕਤਾ ਆਉਂਦੀ ਆ ਕਿ ਮੈਂ ਇਸ ਚੀਜ਼ ਨੂੰ ਪਤਾ ਕਰਾਂ ਔਰ ਇਸ ਚੀਜ਼ ਨੂੰ ਸਿੱਖਾਂ ਤਾਂ ਮੈਂ ਇਸ ਆਪਣੇ ਕਿਤਾਬਾਂ ਨੂੰ ਜੇ ਪੜ੍ਹਨ ਨੂੰ ਤਰਜੀਹ ਦੇਵਾਂ ਤਾਂ ਮੈਂ ਆਪਣੇ ਧਰਮ ਗ੍ਰੰਥ ਨੂੰ ਤਰਜੀਹ ਦਿੰਦੀ ਹਾਂ